ਖੇਡਾਂ ਵਿੱਚ ਨਸਲੀ ਸਮੂਹਾਂ ਅਤੇ ਔਰਤਾਂ ਦੀ ਨੁਮਾਇੰਦਗੀ ਵੀ ਮਾੜੀ ਹੈ ਇਸ ਮੁੱਦੇ 'ਤੇ ਮੇਰੇ ਇਹ ਵਿਚਾਰ ਹਨ ਕਿ ਸਾਨੂੰ ਇਹ ਸਭ ਬਦਲਣਾ ਚਾਹੀਦਾ ਹੈ ਜੇਕਰ ਆਪਾਂ ਆਪਣੇ ਸਮਾਜ ਦਾ ਵਿਕਾਸ ਚਾਹੁੰਦੇ ਹਾਂ ਤਾਂ ਸਾਨੂੰ ਔਰਤਾਂ ਦੀ ਨੁਮਾਇੰਦਗੀ ਕਰਨੀ ਬੰਦ ਕਰਨੀ ਪਵੇਗੀ ਅਤੇ ਖੇਡਾਂ ਵਿੱਚ ਨਸਲੀ ਸਮੂਹਾਂ ਦੇਖਣਾ ਵੀ ਛੱਡਣਾ ਪਵੇਗਾ ਜੇਕਰ ਇਹ ਇੱਦਾਂ ਹੀ ਚੱਲਦਾ ਰਿਹਾ ਤਾਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਸਿਖਾਵਾਂਗੇ ਕਿਉਂਕਿ ਆਉਣ ਵਾਲੀ ਪੀੜ੍ਹੀ ਉਹੀ ਕਰੇਗੀ ਜੋ ਉਹਨਾਂ ਦੇ ਵੱਡੇ ਬਜ਼ੁਰਗ ਕਰ ਰਹੇ ਹਨ ਤਾਂ ਸਾਨੂੰ ਇਹ ਬਹੁਤ ਜ਼ਰੂਰੀ ਹੈ ਕਿ ਇਹ ਜੋ ਚੱਲ ਰਿਹਾ ਹੈ ਇਹਨੂੰ ਇਹਨੂੰ ਰੋਕਿਆ ਜਾਏ ਇਹਨੂੰ ਰੋਕਿਆ ਜਾਏ ਅਤੇ ਖੇਡਾਂ ਵਿੱਚ ਨਸਲੀ ਸਮੂਹਾਂ ਅਤੇ ਔਰਤਾਂ ਦੀ ਨੁਮਾਇੰਦਗੀ ਦਾ ਜੋ ਮੁੱਦਾ ਚੱਲ ਰਿਹਾ ਹੈ ਇਸ ਨੂੰ ਜਲਦ ਤੋਂ ਜਲਦ ਰੋਕਿਆ ਜਾਏ ਇਸ ਵਜ੍ਹਾ ਨਾਲ ਸਾਡੇ ਸਮਾਜ ਦਾ ਮਾਹੌਲ ਵੀ ਖਰਾਬ ਹੋ ਰਿਹਾ ਆ ਅਤੇ ਹੋਰ ਵੀ ਮਾੜੇ ਅਸਰ ਪੈ ਰਹੇ ਹਨ ਸੋ ਇਹਨਾਂ ਨੂੰ ਬਦਲ ਕੇ ਬਿਲਕੁਲ ਸਹੀ ਕਰ ਦੇਣਾ ਚਾਹੀਦਾ ਹੈ ਸਾਨੂੰ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੀ ਜਿਹੜੀ ਨੁਮਾਇੰਦਗੀ ਕਰਦੇ ਹਾਂ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਖੇਡਾਂ ਵਿੱਚ ਸਭ ਨੂੰ ਇੱਕ ਬਰਾਬਰ ਦੇਖਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਪਰਮਾਤਮਾ ਨੇ ਇੱਕੋ ਜਿਹਾ ਬਣਾਇਆ ਹੈ ਤਾਂ ਸਾਨੂੰ ਸਭ ਨੂੰ ਸੇਮ ਬਰਾਬਰ ਦੇਖਣਾ ਚਾਹੀਦਾ ਆ ਅਤੇ ਬਰਾਬਰ ਹੱਕ ਦਿਵਾਉਣਾ ਜਾਂ ਦੇਣਾ ਸਾਡਾ ਫਰਜ਼ ਬਣਦਾ ਹੈ ਸੋ ਮੈਂ ਅਪੀਲ ਕਰਾਂਗੀ ਕਿ ਜਿੰਨੀ ਜਲਦੀ ਹੋ ਸਕੇ ਖੇਡਾਂ ਵਿੱਚ ਨਸਲੀ ਸਮੂਹਾਂ ਅਤੇ ਔਰਤਾਂ ਦੀ ਨੁਮਾਇੰਦਗੀ ਵੀ ਕਰਨੀ ਬੰਦ ਕੀਤੀ ਜਾਏ ਤਾਂ ਕਿ ਸਾਡੇ ਸਮਾਜ ਦਾ ਵਿਕਾਸ ਜੋ ਰੁਕਿਆ ਹੋਇਆ ਹੈ ਉਹ ਚੱਲ ਸਕੇ